ਸਤਿ ਸ਼੍ਰੀ ਅਕਾਲ ਵਾਤਾਵਰਨ ਸਿੱਖਿਆ ਉੱਤੇ ਤਾਂ ਜਿਹੜੀ ਸਰਕਾਰ ਹੈਗੀ ਉਹ ਇਹੀ ਜਿੰਨਾ ਮੈਨੂੰ ਲੱਗਦਾ ਜੀ ਜਿਹੜਾ ਮੇਰਾ ਪਰਸਨਲ ਜਿਹੜਾ ਮੇਰਾ ਵਿਅਕਤੀਗਤ ਜਿਹੜਾ ਅਨੁਭਵ ਹੈ ਉਹ ਤਾਂ ਇਹੀ ਹੈ ਜੀ ਵੀ ਸਕੂਲਾਂ ਦੇ ਵਿੱਚ ਜਿਹੜੀਆਂ ਕਲਾਸਾਂ ਸਾਇੰਸ ਦੀਆਂ ਬੁੱਕਾਂ ਸੀ ਕਿ ਪਹਿਲਾਂ ਵਾਲੀ ਉਹ ਉੱਥੇ ਇੱਕ ਦੋ ਇੱਕ ਦੋ ਚੈਪਟਰ ਹੁੰਦੇ ਸੀ ਪਹਿਲਾਂ ਵਾਤਾਵਰਨ ਸਿੱਖਿਆ ਲਈ ਵੀ ਉਹਨਾਂ ਨੂੰ ਐਟਮੋਸਫੀਅਰ ਨੂੰ ਆਪਾਂ ਕਿਵੇਂ ਬਚਾਉਣਾ ਚਾਹੀਦਾ ਅਤੇ ਕੀ ਆਪਣਾ ਫਾਇਦਾ ਕਰਦਾ ਇਹ ਵਾਤਾਵਰਨ ਜਿਹੜਾ ਹੈਗਾ ਇਨਸਾਨਾਂ ਨੂੰ ਕਿਵੇਂ ਫਾਇਦਾ ਪਹੁੰਚਾਉਂਦਾ ਅਤੇ ਇਹਨੂੰ ਘੱਟ ਤੋਂ ਘੱਟ ਨੁਕਸਾਨ ਕਿਵੇਂ ਆਪਾਂ ਪਹੁੰਚਾਉਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਇੱਕ ਦੋ ਚੈਪਟਰ ਹੁੰਦੇ ਸੀ ਇਕੱਲੇ ਇੱਕ ਦੋ ਪਾਰਟ ਹੁੰਦੇ ਸੀ ਸਾਇੰਸ ਦੀ ਬੁੱਕ ਦੇ ਵਿੱਚ ਲੇਕਿਨ ਬਾਅਦ 'ਚ ਇਹਨੂੰ ਅੱਡ ਈ ਵੀ ਐਸ ਇੱਕ ਸਬਜੈਕਟ ਹੀ ਬਣਾ ਦਿੱਤਾ ਅਲੱਗ ਵਿਸ਼ਾ ਬਣਾ ਦਿੱਤਾ ਇਹਨੂੰ ਅਤੇ ਇਹਦੀ ਪੂਰੀ ਇੱਕ ਅਲੱਗ ਕਿਤਾਬ ਹੁਣ ਲਾਈ ਗਈ ਹੈ ਜਿਹੜੀ ਸਕੂਲਾਂ ਦੇ ਵਿੱਚ ਅਤੇ ਸਕੂਲ ਦੇ ਬਾਅਦ ਵੀ ਕਾਲਜ ਦੇ ਵਿੱਚ ਵੀ ਜਿਹੜੇ ਸਟੂਡੈਂਟ ਪੜ੍ਹਦੇ ਆ ਉਹਨਾਂ ਨੂੰ ਵੀ ਇੱਕ ਇਹ ਸਬਜੈਕਟ ਮੈਂਡੇਟਰੀ ਕਰਤਾ ਜ਼ਰੂਰੀ ਕਰਤਾ ਵੀ ਇਹਨੂੰ ਪਾਸ ਕਰਨਾ ਜ਼ਰੂਰੀ ਹੈ ਤਾਂ ਹੀ ਤੁਸੀਂ ਅੱਗੇ ਆਪਣੀ ਸ਼ਿਕਸ਼ਾ ਨੂੰ ਆਪਣੀ ਸਿੱਖਿਆ ਨੂੰ ਕੰਟੀਨਿਊ ਕਰ ਸਕਦੇ ਹੋ ਅਤੇ ਇਹ ਇਹ ਚੀਜ਼ਾਂ ਜ਼ਰੂਰ ਹੈ ਕਿ ਵੀ ਲੋਕ ਤਾਂ ਕਿ ਅਵੇਅਰ ਰਹੇ ਇਹਦੇ ਲਈ ਅਤੇ ਇਨ ਇਹਦਾ ਵਾਤਾਵਰਨ ਸਿੱਖਿਆ ਦਾ ਥੋੜ੍ਹਾ ਧਿਆਨ ਰੱਖੇ ਧੰਨਵਾਦ